ਮੇਰੇ ਨਾਲ ਮੇਰੀ ਸਹਿਕਰਮੀ ਜਿਹੜੇ ਜਿਹਦਾ ਕਿ ਖਾਣ ਪਾਣ ਬਹੁਤ ਹੀ ਮਾੜਾ ਸੀ ਉਹ ਹਰ ਸਮੇਂ ਤਲੀਆਂ ਚੀਜ਼ਾਂ ਖਾਂਦੀ ਰਹਿੰਦੀ ਸੀ ਜਿਸ ਨਾਲ ਉਹਦੀ ਸਿਹਤ ਖਰਾਬ ਰਹਿਣ ਲੱਗ ਗਈ ਅਤੇ ਮੈਂ ਉਹਨੂੰ ਉਹਦੀ ਤੰਦਰੁਸਤੀ ਅਤੇ ਉਹਦੀ ਜਿਸ ਜਿਹਦੇ ਨਾਲ ਉਹਦੀ ਤੰਦਰੁਸਤੀ ਬਣੀ ਰਹੇ ਅਤੇ ਉਹਦੀ ਜਿਹੜੀਆਂ ਦਵਾਈਆਂ ਲੱਗ ਗਈਆਂ ਹਨ ਉਹਦੀ ਰੋਕਥਾਮ ਲਈ ਮੈਂ ਉਹਨੂੰ ਕਿਹਾ ਕਿ ਤੇਰਾ ਤਾਂ ਖਰਚਾ ਬਹੁਤ ਜ਼ਿਆਦਾ ਹੁੰਦਾ ਰਹਿੰਦਾ ਹੈ ਇਸ ਲਈ ਤੂੰ ਇੰਨਾ ਖਰਚਾ ਕਿੱਥੋਂ ਕੱਢ ਸਕੇਗੀ ਇਸ ਲਈ ਮੈਂ ਇਹਨੂੰ ਕਿਹਾ ਕਿ ਤੂੰ ਕੋਈ ਹੈਲਥ ਇੰਸ਼ੋਰੈਂਸ ਲੈ ਜਿਹਦੇ ਜਿਹਦੇ ਨਾਲ ਤੇਰਾ ਸਾਰਾ ਖਰਚਾ ਜਿਹੜਾ ਹੈ ਉਹ ਸਰਕਾਰ ਚੁੱਕੇਗੀ ਅਸੀਂ ਉੱਥੇ ਇੰਸ਼ੋਰੈਂਸ ਦਾ ਬੜਾ ਹੀ ਫਾਇਦਾ ਹੁੰਦਾ ਹੈ ਜਿਸ ਨਾਲ ਅਸੀਂ ਆਪਣੇ ਮਤਲਬ ਕੀ ਆਪਣੇ ਸਿਹਤ ਦਾ ਧਿਆਨ ਰੱਖ ਸਕਦੇ ਹਾਂ ਹੁਣ ਜਿਵੇਂ ਮੇਰੀ ਸਾਥੀ ਫਨੈਅਸ਼ਲੀ ਉਹ ਨਹੀਂ ਇੰਨਾ ਜ਼ਿਆਦਾ ਕਰ ਸਕਦੀ ਅਤੇ ਜੇ ਉਹ ਹੈਲਥ ਇੰਸ਼ੋਰੈਂਸ ਲਏਗੀ ਤਾਂ ਉਹਦਾ ਜਿਹੜਾ ਖਰਚਾ ਉਹ ਕੰਪਨੀ ਚੱਕੇ ਕੰਪਨੀ ਚੱਕੇਗੀ ਅਤੇ ਸਮੇਂ ਆਉਣ 'ਤੇ ਜਿੱਦਾਂ ਉਹਦਾ ਸਾਰਾ ਧਿਆਨ ਰੱਖੇਗੀ ਅਤੇ ਫਿਰ ਉਹਦੇ ਉਹਨੂੰ ਇਹ ਵੀ ਚਾਹੀਦਾ ਹੈ ਕਿ ਉਹ ਆਪਣੀ ਸਮੇਂ ਸਮੇਂ ਸਿਰ ਆਪਣੀ ਤੰਦਰੁਸਤੀ ਵਾਸਤੇ ਕੋਈ ਕਿਤੇ ਮੈਂਬਰਸ਼ਿਪ ਵੀ ਲੈ ਸਕਦੀ ਹੈ ਜਿੱਦਾਂ ਕਿ ਜਿਹੜੇ ਕਿਸੇ ਦੇ ਨਾਲ ਤੁਸੀਂ ਉਹ ਸਿਖਾਉਂਦੇ ਹਨ ਜਿਵੇਂ ਉਹ ਯੋਗਾ ਵਗੈਰਾ ਇੱਦਾਂ ਵੀ ਕਰ ਸਕਦੀ ਉਹਦੀ ਮੈਂਬਰਸ਼ਿਪ ਲਵੇਗੀ ਅਤੇ ਉਹਦੇ ਨਾਲ ਉਹਦੀ ਸਿਹਤ ਵੀ ਠੀਕ ਰਹੇਗੀ ਅਤੇ ਐਕਸਰਸਾਈਜ਼ ਵੀ ਕਰੇਗੀ ਅਤੇ ਜਿਹੜੀ ਹੁਣ ਹੈਲਥ ਹੈਲਥ ਇੰਸ਼ੋਰੈਂਸ ਲਈ ਗਈ ਅਤੇ ਜੇ ਉਹਨੂੰ ਕਿਸੇ ਤਰ੍ਹਾਂ ਦੀ ਬਿਮਾਰੀ ਲੱਗਦੀ ਹੈ ਤਾਂ ਉਹ ਉਹ ਸਾਰੇ ਆਪਣੇ ਸਾਲ 'ਚ ਜਿਹੜੇ ਵੀ ਰੂਟੀਨ ਚੈੱਕਅਪ ਹੁੰਦੇ ਹਨ ਉਹ ਉਹ ਵੀ ਖਰਚਾ ਚੱਕਦੀ ਹੈ ਹੈਲਥ ਇੰਸ਼ੋਰੈਂਸ ਇਸ ਕਰਕੇ ਉਹਨੂੰ ਵੱਧ ਤੋਂ ਵੱਧ ਆਪਣਾ ਅਤੇ ਸਿਹਤ ਦਾ ਧਿਆਨ ਰੱਖਣਾ ਚਾਹੀਦਾ ਹੈ ਮੈਂ ਉਹਨੂੰ ਦੱਸਿਆ ਅਤੇ ਨਾਲ ਹੀ ਉਹਨੂੰ ਮੈਂ ਕਿਹਾ ਕਿ ਤੂੰ ਆਪਣੀ ਸਿਹਤ ਲਈ ਵਧੀਆ ਵਧੀਆ ਤੋਂ ਵਧੀਆ ਹੈਲਥ ਇੰਸ਼ੋਰੈਂਸ ਕਰ ਤੇਨੂੰ ਥੋੜ੍ਹਾ ਥੋੜ੍ਹਾ ਪੈਸਾ ਦੇਣਾ ਪਏਗਾ ਅਤੇ ਤੇਨੂੰ ਉਹਦੇ ਨਾਲ ਤੈਨੂੰ ਆਪਣਾ ਖਰਚਾ ਚੁੱਕਣਾ ਵੀ ਸਹੀ ਰਹੇਗਾ ਧੰਨਵਾਦ